ਮੇਰੀ ਦੀਦੀ ਦੇ ਵਿਆਹ 'ਤੇ ਮੈਂ ਇੱਕ ਪਰਫੋਰਮੈਂਸ ਕਰਨੀ ਸੀ ਅਤੇ ਉਹ ਪਰਫੋਰਮੈਂਸ ਲਈ ਡਾਂਸ ਮੈਨੂੰ ਕਿਸੇ ਨੇ ਨਹੀਂ ਸਿਖਾਇਆ ਅਤੇ ਉਹ ਡਾਂਸ ਮੈਂ ਆਪਣੇ ਆਪ ਯੂਟਿਊਬ ਤੋਂ ਔਨਲਾਈਨ ਹੀ ਸਿੱਖਿਆ